ਸਰ ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਸਰ ਮੈਂ ਨਾ ਇਹ ਪੁੱਛਣਾ ਸੀਗਾ ਕਿ ਸਾਡਾ ਜਿਹੜਾ ਮਾਲਵੇ ਦਾ ਪਾਣੀ ਆ ਉਹ ਇਹਨਾਂ ਗੰਦਾ ਕਾਹਤੋਂ ਹੋ ਰਿਹਾ ਹੈ ਗਰਾਉਂਡ ਵਾਟਰ ਨਹੀਂ ਸਰ ਚੈੱਕ ਨਹੀਂ ਕਰਵਾਇਆ ਅੱਛਾ ਸਰ ਹਾਂਜੀ ਅੱਛਾ ਸਰ ਮਤਲਬ ਕਿ ਹਾਂਜੀ ਹਾਂਜੀ ਜਿਹਦੇ ਕਰਕੇ ਬਿਮਾਰੀ ਆ ਹਾਂਜੀ ਸਰ ਥੋੜ੍ਹਾ ਬਰਾਉਨ ਜਿਹਾ ਕਲਰ ਤਾਂ ਆ ਰਿਹਾ ਵਾ ਬੜਾ ਡਾਰਕ ਬਰਾਊਨ ਜਿਹਾ

ਹਾਂ ਜੀ ਸਰ ਟੇਸਟ ਤਾਂ ਮੈਂ ਨੋਟਿਸ ਕੀਤਾ ਸੀਗਾ ਬਦਲਿਆ ਹੋਇਆ ਕਾਫੀ ਅੱਛਾ ਸਰ ਇਹਦੇ ਕਰਕੇ ਹੁੰਦਾ ਵਾ ਇਹ ਅੱਛਾ ਸਰ ਅਤੇ ਇਹ ਸਰ ਤਾਂ ਹੀ ਮੈਂ ਕਹਾਂ ਕਾਲਾ ਪੀਲੀਆਂ ਕਿਉਂ ਹੋਇਆ ਮੇਰੇ ਇੱਕ ਟਰੈਂਡ ਦੇ ਡੈਡੀ ਨੂੰ ਹੋਇਆ ਸੀਗਾ ਅਤੇ ਉਹਨੂੰ ਹੋਇਆ ਹੋਇਆ ਆ ਅੱਛਾ ਸਰ ਹਾਂਜੀ ਸਰ ਹਾਂਜੀ ਬਹੁਤ ਠੀਕ ਹਾਂਜੀ ਸਰ ਠੀਕ ਹਾਂਜੀ ਅਤੇ ਸਰ ਫਿਰ ਗੌਰਮੈਂਟ ਇਹਦੇ ਲਈ ਸਖ਼ਤਾਈ ਕਿਉਂ ਨਹੀਂ ਕਰਦੀ ਜਿੰਨੇ ਇੰਡਸਟਰੀ ਕਰਕੇ ਸਾਰਾ ਪਾਣੀ ਗੰਦਾ ਹੋ ਰਿਹਾ ਹਾਂਜੀ ਸਰ ਹਾਂਜੀ ਸਰ ਉਹ ਤਾਂ ਹੈਗਾ ਹੀ ਆ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਇਹ ਚੈੱਕ ਕਿੱਥੇ ਕਰਾਉਣਾ ਪਊਗਾ ਅੱਛਾ ਸਰ ਪੀਏ ਅੱਛਾ ਸਰ ਠੀਕ ਹੈ ਸਰ ਅਤੇ ਸਰ ਇਹ ਕਿੰਨਾ ਟਾਈਮ ਲੱਗ ਜਾਣਾ ਚੈਕਿੰਗ ਨੂੰ ਮਤਲਬ ਕਿ ਪਾਣੀ ਦਾ ਚੈੱਕ ਕਰਾਉਣ ਠੀਕ ਆ ਸਰ ਅਤੇ ਸਰ ਪੈਸੇ ਕਿੰਨੇ ਕੁ ਲੱਗ ਜਾਂਦੇ ਅੱਛਾ ਅਤੇ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਫਸਲ ਹੋਵੇਗੀ

ਅਤੇ ਚਲੋ ਠੀਕ ਹੈ ਸਰ ਫਿਰ ਇਹੀ ਪੁੱਛਣਾ ਸੀਗਾ ਮੈਂ ਤੁਹਾਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ